ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਉਹ ਸਾਡੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਅਤੇ ਹੋਰ ਰਾਜਾਂ ਦੇ ਡਾਂਸ ਉਨ੍ਹਾਂ ਦੇ ਸੰਗੀਤ ਨੂੰ ਸੁਣਨਾ ਪਸੰਦ ਕਰ ਰਹੀ ਹੈ ਇਹਦਾ ਬਹੁਤ ਵੱਡਾ ਕਾਰਨ ਮੋਬਾਈਲ ਫੋਨ ਜੋ ਕਿ ਅਲੱਗ ਅਲੱਗ ਰਾਜਾਂ ਦੇ ਸੱਭਿਆਚਾਰ ਨੂੰ ਸੌਖੇ ਢੰਗ ਨਾਲ ਸਾਡੇ ਤੱਕ ਪਹੁੰਚਾ ਰਹੇ ਦੂਸਰਾ ਵੱਡਾ ਕਾਰਨ ਨਸ਼ਾ ਜੋ ਕਿ ਸਾਡੇ ਪੰਜਾਬ ਨੂੰ ਅੰਦਰੋਂ ਅੰਦਰੀ ਖਾ ਰਿਹਾ ਅਤੇ ਸਾਡੇ ਜਿਹੜਾ ਪੰਜਾਬ ਦਾ ਸੱਭਿਆਚਾਰ ਜਿਵੇਂ ਕਿ ਕਦਰਾਂ ਕੀਮਤਾਂ ਉਹਨਾਂ ਦਾ ਖਾਤਮਾ ਹੁੰਦਾ ਜਾ ਰਿਹਾ ਸਾਡੇ ਨੌਜਵਾਨਾਂ ਦੀ ਖੁਰਾਕ ਸਿਹਤ ਨੂੰ ਲੈ ਕੇ ਗੱਲ ਕਰੀ ਤਾਂ ਬਹੁਤ ਹੀ ਜ਼ਿਆਦਾ ਕਮਜ਼ੋਰ ਸੁੱਕੇ ਪਤਲੇ ਗੱਭਰੂ ਜੋ ਪੈਦਾ ਹੋ ਰਹੇ ਨੇ ਜੋ ਕਿ ਇਹਨਾਂ ਕਦਰਾਂ ਕੀਮਤਾਂ ਨੂੰ ਪਕੜਨ ਵਿੱਚ ਅਸਮਰੱਥ ਦਿਖਾਈ ਦਿੰਦੇ ਨੇ ਸਿਹਤ ਸਾਡੀ ਸਾਡੇ ਸੱਭਿਆਚਾਰ ਨੂੰ ਸੰਭਾਲਣ ਦੇ ਵਿੱਚ ਬਹੁਤ ਮਦਦ ਕਰਦੀ ਹੈ ਕਿਉਂਕਿ ਜੇ ਸਿਹਤ ਚੰਗੀ ਹੋਏਗੀ ਤਾਂ ਹੀ ਉਹਦੇ ਵਿੱਚ ਕੋਈ ਹੁਨਰ ਹੋਵੇਗਾ